ਹੈਲੋ ਸਤਿ ਸ਼੍ਰੀ ਅਕਾਲ ਹਾਂਜੀ ਡੋਮੀਨਿਕ ਤੋਂ ਗੱਲ ਕਰ ਰਹੇ ਹਾਂਜੀ ਮੈਂ ਨਾ ਅੱਧਾ ਘੰਟਾ ਪਹਿਲੇ ਔਡਰ ਦਿੱਤਾ ਸੀ ਪੋਕਿਟਸ ਦਾ ਸੀਗਾ ਅਤੇ ਇੱਕ ਪੋਕਿਟ ਸੀਗਾ ਅਤੇ ਪੀਜ਼ਾ ਸੀਗਾ ਅਤੇ ਕੋਲਡ ਡਰਿੰਕ ਵੀ ਸੀ ਨਾਲ ਅਤੇ ਆਪਣਾ ਬਿਲ ਬਣਿਆ ਸੀ ਪੰਜ ਸੌ ਦਾ ਬਣਿਆ ਸੀਗਾ ਬਿੱਲ ਪੰਜ ਸੌ ਕੁਛ ਰੁਪਏ ਸੀਗੇ ਅਤੇ ਮੈਂ ਨਾਲ ਦੀ ਨਾਲ ਹੀ ਉਹ ਪੇਮੈਂਟ ਕਰਤੀ ਸੀਗੀ ਔਨਲਾਈਨ ਅਤੇ ਹੁਣ ਹੁਣ ਆਇਆ ਸਾਡਾ ਔਡਰ ਅਸੀਂ ਰਿਸੀਵ ਨਾ ਹੁਣ ਕਰਿਆ ਬਟ ਬਿਲਕੁਲ ਵੀ ਮਤਲਬ ਇੱਦਾਂ ਨਹੀਂ ਲੱਗ ਰਿਹਾ ਵੀ ਤੁਸੀਂ ਫਰੈਸ਼ ਬਣਾ ਕੇ ਦਿੱਤਾ ਹੋਵੇ ਜਾਂ ਐਸੀ ਕੋਈ ਗੱਲ ਹੋਈ ਹੋਵੇ ਵੀ ਬਿਲਕੁਲ ਵੀ ਔਡਰ ਫਰੈਸ਼ ਨਹੀਂ ਹੈ ਇੱਕ ਤਾਂ ਉਸ ਤੋਂ ਬਾਅਦ ਠੰਡਾ ਬਿਲਕੁਲ ਐਸੀ ਚੀਜ਼ ਦਾ ਕੋਈ ਫਾਇਦਾ ਨਹੀਂ ਹੈ ਵੀ ਹਾਂ ਵੀ ਮੈਂ ਅਸੀਂ ਤੁਹਾਨੂੰ ਔਡਰ ਕੀਤਾ ਹੈ ਨਾ ਵੀ ਅਸੀਂ ਘਰ ਬੈਠੇ ਇਹ ਚੀਜ਼ ਦੀ ਸਹੂਲਤ ਲੈ ਰਹੇ ਹਾਂ ਬਟ ਗੱਲ ਤਾਂ ਉਹੀ ਹੋ ਗਈ ਨਾ ਵੀ ਸਾਨੂੰ ਜੇ ਠੰਡਾ ਤਾਂ ਐਨਾ ਫਰੈਸ਼ ਅਨਫਰੈਸ਼ ਮਿਲਣਾ ਹੈ ਤਾਂ ਇਸ ਚੀਜ਼ ਦਾ ਕੋਈ ਫਾਇਦਾ ਨਹੀਂ ਹੈ ਪੰਜ ਸੌ ਬਾਰਾਂ ਰੁਪਏ ਹੋਏ ਸੀ ਅਤੇ ਮੈਂ ਇਹੀ ਰਿਕੁਐਸਟ ਕਰਾਂਗੀ ਕਿ ਅਗਰ ਜੇ ਤੁਸੀਂ ਫਿਫਟੀਨ ਮਿੰਟ ਦੇ ਵਿੱਚ ਨਿਊ ਔਡਰ ਬਿਲਕੁਲ ਫਰੈਸ਼ ਦੇ ਸਕਦੇ ਹੋ ਤਾਂ ਦੇਖ ਲਉ ਨਹੀਂ ਤਾਂ ਫਿਰ ਮੈਨੂੰ ਰਿਫੰਡ ਚਾਹੀਦਾ ਕਿਉਂਕਿ ਬਿਲਕੁਲ ਮੂਡ ਔਫ ਹੋ ਚੁੱਕਿਆ ਅਸੀਂ ਚਾਰ ਜਣੇ ਸੀਗੇ ਅਤੇ ਚਾਰ 'ਚੋਂ ਤਿੰਨ ਨੇ ਤਿੰਨ ਨੇ ਵੀ ਨਹੀਂ ਦੋ ਨੇ ਹੀ ਬਸ ਟੇਸਟ ਹੀ ਕੀਤਾ ਅਤੇ ਪਤਾ ਲੱਗ ਗਿਆ ਵੀ ਹਾਂ ਵੀ ਕਿਸ ਤਰ੍ਹਾਂ ਦਾ ਤੁਸੀਂ ਔਡਰ ਭੇਜਿਆ ਹੈਗਾ ਅਤੇ ਸਵੀਗੀ 'ਤੇ ਆਇਆ ਸੀ ਬੰਦਾ ਦੇਣ ਸਵਿਗੀ ਵਾਲੇ ਨੂੰ ਔਡਰ ਕੀਤਾ ਸੀਗਾ ਅਤੇ ਤੁਸੀਂ ਔਡਰ ਨੰਬਰ ਉਸ ਤੋਂ ਚੈੱਕ ਕਰ ਲਉ ਹੁਣ ਤੁਹਾਡੇ ਕੋਲ ਉਹ ਬੰਦਾ ਆ ਰਿਹਾ ਹੋਏਗਾ ਅਤੇ ਰਿਕੁਐਸਟ ਹੀ ਕਰ ਸਕਦੀ ਹਾਂ ਜੀ ਰਿਫੰਡ ਕਰ ਦਿਓਗੇ ਤਾਂ ਮਚ ਬੈਟਰ ਹੋਏਗਾ ਕਿਉਂਕਿ ਤੁਹਾਨੂੰ ਪਤਾ ਵੀ ਜਦੋਂ ਇੱਕ ਵਾਰੀ ਫਿਰ ਅਸੀਂ ਮਤਲਬ ਕਿਵੇਂ ਖਾ ਸਕਦੇ ਹਾਂ ਹੁਣ ਦੁਬਾਰਾ ਟਰਸਟ ਕਰਨਾ ਔਖਾ ਬਾਕੀ ਜੇ ਤੁਸੀਂ ਬੈਸਟ ਐਂਡ ਫਰੈਸ਼ ਭੇਜ ਸਕਦੇ ਹੋ ਤਾਂ ਦੇਖ ਲਉ ਅਦਰਵਾਈਜ਼ ਮੈਨੂੰ ਪੰਦਰਾਂ ਤੋਂ ਵੀਹ ਮਿੰਟ ਦੇ ਵਿੱਚ ਦੇ ਵਿੱਚ ਮੈਨੂੰ ਆਪਣੀ ਪੇਮੈਂਟ ਰਿਫੰਡ ਬੈਕ ਚਾਹੀਦੀ ਹੈ ਜੀ ਧੰਨਵਾਦ